ਹੈਲੋ ਫਲਿੱਪਕਾਰਟ ਮੈਂ ਤੁਹਾਡੇ ਕੋਲ ਇੱਕ ਫ਼ੋਨ ਆਰਡਰ ਕੀਤਾ ਸੀ ਸੈਮਸੰਗ ਦਾ ਅਤੇ ਉਹ ਮੈਨੂੰ ਬਹੁਤ ਵਧੀਆ ਲੱਗਿਆ ਉਹ ਟਾਈਮ ਤੋਂ ਪਹਿਲਾ ਆ ਗਿਆ ਇੱਕ ਤਾਂ ਇਹ ਮੈਨੂੰ ਬਹੁਤ ਵਧੀਆ ਲੱਗੀ ਤੁਹਾਡੀ ਸਰਵਿਸ ਅਤੇ ਉਸ ਤੋਂ ਬਾਅਦ ਜੋ ਮੈਂ ਕਲਰ ਆਰਡਰ ਕੀਤਾ ਸੀ ਉਹ ਕਲਰ ਆਇਆ ਮੇਰੇ ਕੋਲ ਅਤੇ ਫ਼ੋਨ ਦੀ ਗੱਲ ਕਰਾਂ ਤਾਂ ਇਸਦਾ ਸਾਰਾ ਕੈਮਰਾ ਕੁਮਰਾ ਕੁਆਲਿਟੀ ਬਹੁਤ ਵਧੀਆ ਹੈ ਕਲਰ ਵੀ ਦੇਖਣ 'ਚ ਬਹੁਤ ਵਧੀਆ ਲੱਗ ਰਿਹਾ ਹੈ ਉਸ ਤੋਂ ਬਾਅਦ ਇਹਦੇ ਫੀਚਰਜ਼ ਦੀ ਗੱਲ ਕਰਾਂ ਬੈਟਰੀ ਵਗੈਰਾ ਸਾਰਾ ਕੁਝ ਪਰਮਾਨੈਂਟ ਹੈ ਵਧੀਆ ਚੱਲ ਰਿਹਾ ਹੈ ਜਿਹੜਾ ਬੈਟਰੀ ਬੈਕਅੱਪ ਹੈ ਵਧੀਆ ਕੱਢ ਰਿਹਾ ਹੈ ਆਪਣਾ ਚਾਰਜਰ ਜਿਹੜਾ ਇਹਦਾ ਉਸ ਤੋਂ ਵੀ ਵਧੀਆ ਹੈ ਚਾਰਜਰ ਮਿੰਟ ਮਾ ਇਹ ਚਾਰਜ ਕਰ ਦਿੰਦਾ ਮਤਲਬ ਜ਼ਿਆਦਾ ਟਾਈਮ ਨਹੀਂ ਲਗਾਉਂਦਾ ਬਾਕੀ ਫ਼ੋਨਾਂ ਦੇ ਵਾਂਗ ਥੈਂਕ ਯੂ ਸੋ ਮੱਚ